ਹੈਲੋ ਮੈਂ ਅੱਜ ਤੁਹਾਡੇ ਨਾਲ ਆਪਣਾ ਤਜਰਬੇ ਸਾਂਝਾ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਮੇਰੇ ਬੱਚੀ ਦਾ ਜਨਮ ਦਿਨ ਸੀਗਾ ਅਤੇ ਬਹੁਤ ਸਾਰੇ ਲੋਕਾਂ ਨੇ ਆਉਣਾ ਸੀਗਾ ਅਤੇ ਉਹਦੇ ਵਾਸਤੇ ਮੈਨੂੰ ਖਾਣੇ ਬਣਾਉਣ ਵਿੱਚ ਬੜੀ ਮੁਸ਼ਕਲ ਆਈ ਜਿਵੇਂ ਕਿ ਸਾਡਾ ਘਰ ਬਹੁਤ ਹੀ ਛੋਟਾ ਸੀਗਾ ਉਹਦੇ ਕਰਕੇ ਸਾਨੂੰ ਚੁੱਲ੍ਹੇ ਦੀ ਵਰਤੋਂ ਵੀ ਕਰਨਾ ਪਈ ਦੋ ਤਿੰਨ ਚੁੱਲ੍ਹਿਆਂ ਦੀ ਵਰਤੋਂ ਕੀਤੀ ਫੇਰ ਸਾਨੂੰ ਨਾਲ ਭੱਠੀ ਦੀ ਵੀ ਲੋੜ ਪਈ ਇੱਕ ਸਾਈਡ 'ਤੇ ਫਿਰ ਅਸੀਂ ਸਬਜ਼ੀ ਬਣਾ ਲਈ ਮਟਰ ਪਨੀਰ ਦੀ ਫਿਰ ਦੂਜੀ ਥਾਂ 'ਤੇ ਚੌਲ ਬਣਾ ਲਏ ਫਿਰ ਇੱਕ ਥਾਂ 'ਤੇ ਮਿਕਸ ਸਬਜ਼ੀ ਬਣਾਈ ਫਿਰ ਇੱਕ ਥਾਂ 'ਤੇ ਰੋਟੀ ਬਣਵਾਈ ਇੰਨੀ ਮੁਸ਼ਕਲ ਆਈ ਕਿ ਬੜੀ ਮਤਲਬ ਕਿ ਤੇਜ਼ੀ ਨਾਲ ਖਾਣਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਟੈਮ ਵੀ ਨੌਂ ਤੋਂ ਦਸ ਦਾ ਸੀ ਇਹ ਦੋ ਘੰਟਿਆਂ ਦੇ ਵਿੱਚ ਸਾਰਾ ਕੁਝ ਹੀ ਤਿਆਰ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਮਤਲਬ ਇਹ ਵੀ ਬੜਾ ਵਧੀਆ ਹੀ ਦੋ ਘੰਟਿਆਂ ਦੇ ਵਿੱਚ ਬੜਾ ਵਧੀਆ ਖਾਣਾ ਬਣ ਗਿਆ ਸਾਰਿਆਂ ਨੇ ਖਾ ਕੇ ਖਾਣੇ ਦੀ ਬੜੀ ਸਿਫਤ ਕੀਤੀ ਪਰ ਇਹ ਹੀ ਮੈਨੂੰ ਬਹੁਤ ਹੀ ਹੀ ਜਿਵੇਂ ਕਿ ਖਾਣਾ ਬੜੀ ਮੁਸ਼ਕਲ ਨਾਲ ਬਣਿਆ ਹੈ ਇਹ ਹੋ ਸਕਦਾ ਹੈ ਕਿ ਇਹ ਖਾਣਾ ਸਹੀ ਵੀ ਨਾ ਬਣਿਆ ਹੋਵੇ ਪਰ ਖਾ ਕੇ ਸਾਰਿਆਂ ਨੇ ਖਾਣਾ ਬੜਾ ਹੀ ਪਸੰਦ ਕੀਤਾ ਅਤੇ ਸਾਰਿਆਂ ਨੇ ਮੇਰੀ ਸਿਫਤ ਵੀ ਬਹੁਤ ਕੀਤੀ ਇਹ ਕਿ ਮੈਨੂੰ ਖਾਣਾ ਬਣਾਉਣ ਵਿੱਚ ਬਹੁਤ ਹੀ ਵੈਸੇ ਮੁਸ਼ਕਲ ਆਈ ਸੀਗੀ